ਮੇਰੇ ਇਲਾਕੇ ਵਿੱਚ ਕਈ ਤਰ੍ਹਾਂ ਦੇ ਮਹਿਲ ਅਤੇ ਕਿਲ੍ਹੇ ਹਨ ਉਹਨਾਂ 'ਚੋਂ ਇੱਕ ਕਿਲ੍ਹਾ ਮੁਬਾਰਕ ਹੈ ਇਹ ਪਟਿਆਲੇ ਮਹਾਰਾਜਿਆਂ ਦਾ ਖਾਸ ਕਿਲ੍ਹਾ ਸੀ ਇੱਥੋਂ ਹੀ ਉਹ ਸਾਰਾ ਕਾਰਜ ਕੰਮ ਕਰਦੇ ਸੀ ਇੱਥੇ ਹੀ ਦਰਬਾਰ ਲਾਉਂਦੇ ਸੀ ਲੋਕਾਂ ਦੀਆਂ ਦੁੱਖ ਸੁਣਦੇ ਸੀ ਅਤੇ ਫੈਸਲੇ ਲੈਂਦੇ ਸੀ ਦੂਜਾ ਕਿਲ੍ਹਾ ਸ਼ੀਸ਼ ਮਹਿਲ ਹੈ ਇਹ ਮਹਾਰਾਜਾ ਭੁਪਿੰਦਰ ਸਿੰਘ ਦਾ ਕਿਲ੍ਹਾ ਸੀਗਾ ਇੱਥੇ ਉਹਨਾਂ ਨੇ ਆਪਣੀਆਂ ਰਾਣੀਆਂ ਲਈ ਬਹੁਤ ਵੱਡਾ ਤਲਾਬ ਬਣਾਇਆ ਸੀ ਜਿੱਥੇ ਉਹ ਰੰਗ ਰਲੀਆਂ ਮਨਾਉਂਦੇ ਸੀ ਇੱਕ ਹੋਰ ਕਿਲਾ ਬਹਾਦਰਗੜ ਫੋਰਟ ਦੇ ਨਾਂ ਨਾਲ ਪ੍ਰਸਿੱਧ ਹੈ ਇਹਦਾ ਇਤਿਹਾਸ ਥੋੜ੍ਹਾ ਧਾਰਮਿਕ ਹੈ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਚਰਨ ਪਾਏ ਸੀ ਇੱਥੇ ਪਹਿਲਾਂ ਉਹ ਦਸ ਦਿਨ ਲਈ ਆਏ ਸੀਗੇ ਤਾਂ ਇੱਥੋਂ ਦੇ ਇੱਕ ਸਫੇ ਖਾਨ ਨੂੰ ਵਾਅਦਾ ਕੀਤਾ ਸੀ ਮੈਂ ਮੁੜਦੇ ਹੋਏ ਦੁਬਾਰਾ ਫਿਰ ਆਵਾਂਗਾ ਜਦੋਂ ਉਹ ਦਿੱਲੀ ਸ਼ਹਾਦਤ ਦੇਣ ਲਈ ਜਾ ਰਹੇ ਸੀ ਤਾਂ ਉਹ ਇੱਥੇ ਰਹਿ ਕੇ ਗਏ ਸੀ ਉਹਨਾਂ ਨੇ ਇੱਥੇ ਤਿੰਨ ਮਹੀਨੇ ਅਤੇ ਤਿੰਨ ਦਿਨ ਭਗਤੀ ਕੀਤੀ ਅਤੇ ਇੱਥੇ ਰਹੇ ਤਾਂ ਇਹ ਕਿਲ੍ਹਾ ਉਹਨਾਂ ਦੇ ਨਾਂ 'ਤੇ ਹੀ ਮਸ਼ਹੂਰ ਹੋ ਗਿਆ ਬਹਾਦਰਗੜ੍ਹ ਫੋਰਟ ਅਤੇ ਹੋਰ ਵੀ ਕਈ ਪਟਿਆਲੇ ਜ਼ਿਲ੍ਹੇ ਵਿੱਚ ਕਿਲ੍ਹੇ ਪੈਂਦੇ ਹਨ ਜਿਵੇਂ ਕਿ ਨਾਭਾ ਰਿਆਸਤ ਦੇ ਕਈ ਕਿਲ੍ਹੇ ਹਨ ਸਮਾਣਾ ਵੀ ਪਟਿਆਲਾ ਦੇ ਅੰਦਰ ਹੀ ਆਉਂਦਾ ਹੈ ਅਤੇ ਇਸ ਰਿਆਸਤ 'ਤੇ ਵੀ ਕਈ ਸਾਰੇ ਕਿਲ੍ਹੇ ਹਨ